ਹਾਂਜੀ ਮੈਂ ਗਣੇਸ਼ ਜਯੰਤੀ ਦੇ ਮੌਕੇ 'ਤੇ ਪਹਿਲੀ ਵਾਰ ਗਣੇਸ਼ ਜੀ ਦੀ ਮੂਰਤੀ ਬਣਾਈ ਪਹਿਲੀ ਵਾਰ ਗਣੇਸ਼ ਜੀ ਦੀ ਮੂਰਤੀ ਬਣਾਉਣੀ ਮੈਨੂੰ ਬਹੁਤ ਮੁਸ਼ਕਿਲ ਲੱਗ ਰਹੀ ਸੀ ਮੈਂ ਗਿੱਲੀ ਮਿੱਟੀ ਦੀ ਵਰਤੋਂ ਕਰਕੇ ਗਣੇਸ਼ ਜੀ ਦੀ ਮੂਰਤੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੂਰਤੀ ਮੇਰੇ ਕੋਲ ਸਹੀ ਢੰਗ ਨਾਲ ਬਣ ਨਹੀਂ ਸੀ ਰਹੀ ਮੈਨੂੰ ਮੂਰਤੀ ਬਣਾਉਣੀ ਬਹੁਤ ਮੁਸ਼ਕਿਲ ਲੱਗ ਰਹੀ ਸੀ ਮੈਂ ਮੂਰਤੀ ਬਣਾ ਤਾਂ ਲਈ ਪਰ ਉਹ ਮੂਰਤੀ ਬਣਾ ਕੇ ਮੈਨੂੰ ਸੰਤੁਸ਼ਟੀ ਪ੍ਰਾਪਤ ਨਹੀਂ ਹੋਈ ਉਸ ਤੋਂ ਬਾਅਦ ਮੈਂ ਫਿਰ ਤੋਂ ਗਣੇਸ਼ ਜੀ ਦੀ ਮੂਰਤੀ ਬਣਾਉਣ ਦੀ ਕੋਸ਼ਿਸ਼ ਕੀਤੀ ਇਸ ਵਾਰ ਉਹ ਮੂਰਤੀ ਮੇਰੇ ਕੋਲ ਬਹੁਤ ਸਹੀ ਢੰਗ ਨਾਲ ਬਣ ਰਹੀ ਸੀ ਇਸ ਵਾਰ ਗਣੇਸ਼ ਜੀ ਦੀ ਮੂਰਤੀ ਬਣਾਉਣ ਵਿੱਚ ਮੈਨੂੰ ਇੰਨੀ ਮੁਸ਼ਕਿਲ ਨਹੀਂ ਸੀ ਲੱਗ ਰਹੀ ਇਸ ਵਾਰ ਉਹ ਮੂਰਤੀ ਬਹੁਤ ਨਿਖਰ ਕੇ ਸਾਹਮਣੇ ਆ ਰਹੀ ਸੀ ਮੈਨੂੰ ਖੁਦ 'ਤੇ ਯਕੀਨ ਨਹੀਂ ਸੀ ਹੋ ਰਿਹਾ ਉਹ ਮੂਰਤੀ ਬਹੁਤ ਸਹੀ ਢੰਗ ਨਾਲ ਬਣ ਗਈ ਫਿਰ ਮੈਂ ਗਣੇਸ਼ ਜੀ ਦੀ ਮੂਰਤੀ 'ਤੇ ਰੰਗ ਕੀਤਾ ਅਤੇ ਉਹ ਮੂਰਤੀ ਬਹੁਤ ਨਿਖਰ ਕੇ ਸਾਹਮਣੇ ਆਈ ਮੈਨੂੰ ਉਹ ਮੂਰਤੀ ਬਣਾ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਇਹ ਅਨੁਭਵ ਮੇਰੇ ਲਈ ਬਹੁਤ ਵਧੀਆ ਸੀ